ਟੈਕਨੋਲਜੀ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਗਈ ਸਾਡੇ ਆਮ ਜ ਜਨ ਜੀਵਨ ਨੂੰ ਉਹਦੇ 'ਚ ਜਿਵੇਂ ਪਰਿਵਾਰ ਇਕੱਠੇ ਹੋ ਕੇ ਬੈਠਦੇ ਤੇ ਉਹ ਚੀਜ਼ ਖਤਮ ਹੋ ਗਈ ਹਰੇਕ ਬੰਦੇ ਦੇ ਆਪਣੇ ਹੱਥ ਦੇ ਵਿੱਚ ਇੱਕ ਮੋਬਾਈਲ ਫੋਨ ਆ ਗਿਆ ਆਪਣੇ ਕਮਰੇ 'ਚ ਇੱਕ ਟੀ ਵੀ ਆ ਗਿਆ ਅਤੇ ਉਹ ਆਪਣੇ ਆਪ ਦੇ ਵਿੱਚ ਹੀ ਰੁੱਝ ਗਿਆ ਉਹ ਸਵੇਰੇ ਸੁੱਤਾ ਉੱਠ ਕੇ ਸਾਰੇ ਕੰਮ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਨੂੰ ਵੇਖਦਾ ਫਰੋਲਦਾ ਹੈ ਉਹਨੇ ਕਿਸੇ ਦਾ ਹਾਲ ਨਹੀਂ ਪੁੱਛਣਾ ਕੋਈ ਕਿਸੇ ਨਾਲ ਗੱਲ ਨਹੀਂ ਕਰਨੀ ਬੱਚੇ ਬਹੁਤ ਬਹੁਤ ਦੇਰ ਤੱਕ ਆਪਣੇ ਕਮਰਿਆਂ ਤੋਂ ਬਾਹਰ ਨਹੀਂ ਆਉਂਦੇ ਮਾਂ ਬਾਪ ਦੇ ਵਿੱਚ ਬੈਠਦੇ ਨਹੀਂ ਉਹਨਾਂ ਦੇ ਵਿੱ ਮਾਂ ਬਾਪ ਦੇ ਵਿੱਚ ਨਾ ਬੈਠਣਾ ਇੱਕ ਬਹੁਤ ਬੜਾ ਪ੍ਰਭਾਵ ਛੱਡ ਕੇ ਜਾਂਦਾ ਸਮਾਜ ਦੇ ਉੱਪਰ ਕਿ ਜਿਹਦੇ 'ਚ ਕਿ ਤੁਹਾਨੂੰ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਔਖੀ ਹੋ ਜਾਂਦੀ ਆ ਕਿ ਤੁਸੀਂ ਕਿਸ ਤਰੀਕੇ ਨਾਲ ਵਿਚਾਰਨਾ ਵਿਚਰਨਾ ਸਮਾਜ ਦੇ ਵਿੱਚ ਅਤੇ ਲੋਕਾਂ ਨਾਲ ਮੇਲ ਜੋਲ ਕਿਵੇਂ ਰੱਖਣਾ ਕਿਵੇਂ ਤੁਸੀਂ ਪਰਸਥਿਤੀਆਂ ਨੂੰ ਸੰਭਾਲਣਾ ਹੈ ਅਤੇ ਕਿਵੇਂ ਤੁਸੀਂ ਆਪਣੇ ਪਰਿਵਾਰ ਨੂੰ ਔਰ ਆਪਣੇ ਵਿਰਸੇ ਨੂੰ ਸੰਭਾਲਣਾ ਇਹ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਕਿ ਟੈਕਨੋਲਜੀ ਨੇ ਖ਼ਤਮ ਕਰਤੀਆਂ ਜਿਵੇਂ ਕਿ ਹੁਣ ਆਪਾਂ ਫੋਨ ਦੇ ਉੱਪਰ ਕਿਸੇ ਨਾਲ ਗੱਲ ਕਰਨੀ ਹੈ ਕੋਈ ਬੰਦਾ ਪਹਿਲਾਂ ਚਿੱਠੀ ਲਿਖਦਾ ਤਾ ਤਾਂ ਉਹ ਹੱਥ ਨਾਲ ਲਿਖਦਾ ਤਾ ਤਾਂ ਉਹ ਤੋਂ ਉਹਦੀ ਲਿਖਤੀ ਵੀ ਸ ਪ੍ਰਭਾਵਿਤ ਹੁੰਦੀ ਤੀ ਉਹਨੂੰ ਲਿਖਣਾ ਆਉਣਾ ਪੈਂਦਾ ਤਾ ਹੁਣ ਉਹ ਚੀਜ਼ਾਂ ਖ਼ਤਮ ਹੋ ਗਈਆਂ ਹੁਣ ਬੋਲਿਆ ਫੋਨ 'ਤੇ ਗੱਲ ਹੋਈ ਕੰਮ ਹੋ ਗਿਆ ਤਾਂ ਕਈ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਉਨ੍ਹਾਂ ਨੇ ਖਤਮ ਕਰਤੀਆਂ ਵਿਰਸੇ ਦੇ ਵਿੱਚੋਂ ਗਾਇਬ ਹੋਈਆਂ ਚਲੇ ਗਈਆਂ ਟੈਲੀਗਰਾਮਾਂ ਦੀ ਤੀ ਉਹ ਖ਼ਤਮ ਹੋ ਗਈ ਅਸੀਂ ਕਿਸੇ ਨੂੰ ਚਿੱਠੀ ਪੋਸਟ ਕਰਨੀ ਪੋਸਟਕਾਰਡ ਭੇਜਣਾ ਉਹ ਚੀਜ਼ਾਂ ਟੈਕਨੋਲਜੀ ਨੇ ਪ੍ਰਭਾਵਿਤ ਕਰਤੀਆਂ ਤਾਂ ਉਹ ਚੀਜ਼ਾਂ ਲੰਮੀਆਂ ਤੀਆਂ ਪਰ ਸੁੱਖ ਦਿੰਦੀਆਂ ਸੀਗੀਆਂ ਜਦੋਂ ਅਸੀਂ ਇੱਕ ਦੂਜੇ ਦੀ ਲਿਖੀ ਹੋਈ ਚਿੱਠੀ ਨੂੰ ਉਹਦੇ ਹੱਥ ਨੂੰ ਪੜ੍ਹਦੇ ਤੇ ਤਾਂ ਇੱਕ ਆਪਣਾਪਣ ਮਹਿਸੂਸ ਹੁੰਦਾ ਤਾ ਹੁਣ ਉਹ ਚੀਜ਼ ਖਤਮ ਹੋ ਚੁੱਕੀ ਹੈ ਸਮਾਜ 'ਚੋਂ